ਹਾਂਜੀ ਸਤਿ ਸ਼੍ਰੀ ਅਕਾਲ ਸਰ ਤੁਸੀਂ ਫਲਿੱਪਕਾਰਟ ਤੋਂ ਬੋਲ ਰਹੇ ਹੋ ਨਾ ਹੈਲਪਲਾਈਨ ਨੰਬਰ ਹਾਂਜੀ ਹਾਂਜੀ ਸਰ ਮੈਂ ਨਾ ਸ਼ੂਜ ਔਡਰ ਕੀਤੇ ਸੀ ਕਿ ਮੇਰਾ ਨਾਮ ਅਮਨਦੀਪ ਕੌਰ ਹੈ ਹਾਂਜੀ ਹਾਂਜੀ ਸਰ ਮੈਂ ਨਾ ਸ਼ੂਜ ਔਡਰ ਕੀਤੇ ਸੀ ਤੁਹਾਡੇ ਤੋਂ ਅਤੇ ਇੱਕ ਤਾਂ ਉਹ ਬਿਲਕੁਲ ਵੀ ਸਹੀ ਨਹੀਂ ਆਏ ਅਤੇ ਦੂਸਰਾ ਡਿਲੀਵਰੀ ਬੋਆਏ ਦਾ ਬਿਹੇਵੀਅਰ ਜਿਹੜਾ ਸੀ ਨਾ ਗੱਲ ਕਰਨ ਦਾ ਤਰੀਕਾ ਮੈਨੂੰ ਬਿਲਕੁਲ ਸਹੀ ਨਹੀਂ ਲੱਗਿਆ ਮੇਰੇ ਸ਼ੂਜ ਦੇ ਨੰਬਰ ਜਿਹੜਾ ਮੈਂ ਔਡਰ ਕੀਤਾ ਸੀ ਉਸ ਤੋਂ ਛੋਟੇ ਸਾਈਜ਼ ਆਏ ਦੋ ਪੇਅਰ ਅਤੇ ਦੋ ਪੇਅਰ ਵੱਡੇ ਸਾਈਜ਼ ਆਏ ਮੇਰੇ ਅਕੋਡਿੰਗ ਦਾ ਸਾਈਜ਼ ਆਇਆ ਹੀ ਨਹੀਂ ਅਤੇ ਜਿਹੜਾ ਡਿਲੀਵਰੀ ਬੋਆਏ ਦਾ ਤਰੀਕਾ ਸੀ ਨਾ ਗੱਲ ਕਰਨ ਦਾ ਬਹੁਤ ਹੀ ਜ਼ਿਆਦਾ ਗੰਦਾ ਸੀ ਇੱਦਾਂ ਲੱਗ ਰਿਹਾ ਸੀ ਜਿਵੇਂ ਕਿ ਮਤਲਬ ਕੋਈ ਕਿੱਦਾਂ ਕਿਵੇਂ ਇਨਸਾਨ ਕਿਸੇ ਨੂੰ ਕੁੜੀ ਨਾਲ ਗੱਲ ਕਰਨ ਦੀ ਤਮੀਜ਼ ਨਹੀਂ ਸੀ ਹਾਂਜੀ ਹਾਂਜੀ ਸਰ ਤੁਸੀਂ ਇੱਕ ਵਾਰੀ ਮੇਰਾ ਔਰ ਮੈਂ ਔਡਰ ਤਾਂ ਕੈਂਸਲ ਕਰ ਦਿੱਤਾ ਵਾ ਬਟ ਇਟਸ ਵੈਰੀ ਮੈਂ ਬਹੁਤ ਹੀ ਡਿਸਅਪੋਇੰਟ ਹੋਈ ਹਾਂ ਤੁਹਾਡੇ ਤੋਂ ਕਿ ਮੈਂ ਬਹੁਤ ਮਤਲਬ ਕਾਫ਼ੀ ਸਕਰੋਲ ਕਰਨ ਤੋਂ ਬਾਅਦ ਆਹ ਸ਼ੂਜ ਮੈਨੂੰ ਪਸੰਦ ਆਏ ਸੀ ਅਤੇ ਮੈਂ ਔਡਰ ਕੀਤੇ ਸੀ ਬਟ ਨਾ ਤਾਂ ਤਾਂਹ ਕੁਆਲਿਟੀ 'ਚ ਗੁੱਡ ਸੀ ਅਤੇ ਨਾ ਹੀ ਮੈਨੂੰ ਮੇ ਮੇਰੇ ਅਕੋਡਿੰਗ ਉਹਦਾਂ ਦਾ ਸਾਈਜ਼ ਸੀਗਾ ਸੋ ਅੱਗੇ ਤੋਂ ਤੁਸੀਂ ਪਲੀਜ਼ ਜੇ ਮੈਂ ਕੋਈ ਔਡਰ ਕਰਾਂ ਤਾਂ ਪਲੀਜ਼ ਮੇਰੀ ਹੈਲਪ ਕਰਨਾ ਕਿ ਮੈਨੂੰ ਸਹੀ ਔਡਰ ਪਹੁੰਚੇ ਅਦਰਵਾਈਜ਼ ਆਈ ਵਿਲ ਰੇਟਿੰਗ ਯੂ ਜੀਰੋ ਥੈਂਕ ਯੂ ਸੋ ਮਚ ਓਕੇ ਓਕੇ ਧੰਨਵਾਦ